ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਤੁਹਾਡੇ ਕੋਲ ਚੂੜੀਆਂ ਮੰਗਾਈਆਂ ਸੀਆਂ ਬਹੁਤ ਵਧੀਆ ਨਿਕਲੀਆਂ ਮੈਂ ਲਾਲ ਰੰਗ ਮੰਗਾਇਆ ਸੀ ਲਾਲ ਰੰਗ ਬਹੁਤ ਵਧੀਆ ਸੀਗਾ ਕੱਚ ਵੀ ਬਹੁਤ ਵਧੀਆ ਸੀਗਾ ਅਤੇ ਜਿਹੜਾ ਡਜੈਨ ਸੀ ਉਹੀ ਬਹੁਤ ਵਧੀਆ ਸੀਗਾ ਬਹੁਤ ਵਧੀਆ ਚੂੜੀਆਂ ਸੀਗੀਆਂ ਮੈਂ ਕਿਸੇ ਵਿਆਹ 'ਤੇ ਪਾ ਕੇ ਗਈ ਸੀ ਉਹਨਾਂ ਨੇ ਕਿਹਾ ਚੂੜੀਆਂ ਬੜੀਆਂ ਸੋਹਣੀਆਂ ਵਾ ਅਤੇ ਮੈਂ ਫਿਰ ਉਹਨਾਂ ਨੂੰ ਦੱਸਿਆ ਮੈਂ ਕਿਹਾ ਮੈਂ ਔਨਲਾਈਨ ਮੰਗਾਈਆਂ ਵਾਂ ਅਤੇ ਕਹਿੰਦੇ ਫਿਰ ਉਹਨਾਂ ਨੂੰ ਵੀ ਔਡਰ ਕਰ ਕਹਿੰਦੇ ਉਹਨਾਂ ਨੇ ਮੇਰੇ ਕੋਲੋਂ ਡਰੈਸ ਲਿੱਤਾ ਉਹਨਾਂ ਨੂੰ ਐਡਰੈਸ ਦੇ ਦਿੱਤਾ ਫਿਰ ਉਹਨਾਂ ਨੇ ਮੰਗਾਈਆਂ ਚੂੜੀਆਂ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਅਸੀਂ ਚੂੜੀਆਂ ਮੰਗਾ ਜਿਹੜੀਆਂ ਤੁਸੀਂ ਔਡਰ ਕੀਤਾ ਸੀ ਨਾ ਵੀ ਤੁਸੀਂ ਮੈਨੂੰ ਦੱਸਿਆ ਸੀ ਐਡਰੈਸ ਮੈਂ ਉਹ ਚੂੜੀਆਂ ਮੰਗਾਈਆਂ ਵਾਂ ਕਹਿੰਦੇ ਚੂੜੀਆਂ ਬਹੁਤ ਵਧੀਆ ਵਾ ਬਹੁਤ ਵਧੀਆ ਵ ਮੈਂ ਫਿਰ ਕਹਿੰਦੇ ਮੇਰੀ ਮੰਮੀ ਉਨਾ ਨੇ ਵੀ ਮੇਰੀ ਭੈਣਾਂ ਨੇ ਵੀ ਚੂੜੀਆਂ ਮੰਗਾਣੀਆਂ ਵਾ ਅਤੇ ਉਹਨਾਂ ਨੂੰ ਵੀ ਮੇਰੇ ਕੋਲ ਐਡਰੈਸ ਲਿੱਤਾ ਵਾ ਬਹੁਤ ਬਹੁਤ ਕਹਿੰਦੇ ਬਹੁਤ ਵਧੀਆ ਸੀਗੀਆਂ ਚਲੋ ਓ ਅ ਜਿਦਾਂ ਬਾਕੀ ਵੀ ਸਮਾਨ ਮੰਗਾਉਣਾ ਹੋਇਆ ਤੁਹਾਡੇ ਕੋਲ ਮੰਗਾਵਾਂਗੇ ਹਾਂਜੀ ਧੰਨਵਾਦ ਜੀ